ਆਪਣੇ ਸਕੂਲ ਸਮੇਂ ਵਿੱਚ ਮੈਂ ਕਾਫੀ ਜ਼ਿਆਦਾ ਚਿੱਤਰਕਾਰੀ ਕੀਤੀ ਹੋਈ ਹੈ ਪੇਂਟਿੰਗ ਵੀ ਕੀਤੀ ਹੋਈ ਹੈ ਚਿੱਤਰਕਾਰੀ ਵਿੱਚ ਮੈਂ ਕਾਫੀ ਜ਼ਿਆਦਾ ਕਾਰਟੂਨਾਂ ਦੇ ਚਿੱਤਰ ਵੀ ਬਣਾਏ ਹੋਏ ਹਨ ਜਿਵੇਂ ਕਾਰਟੂਨਾਂ ਦੇ ਚਿੱਤਰ ਛੋਟਾ ਬੀਮ ਡੋਰੀਮੋਨ ਬੈਨ ਟੈਨ ਹੋਰ ਵੀ ਕਾਫੀ ਜ਼ਿਆਦਾ ਮੈਂ ਕਾਰਟੂਨਾਂ ਦੇ ਚਿੱਤਰ ਬਣਾਏ ਹੋਏ ਹਨ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਬਣੇ ਸੀਗੇ ਅਤੇ ਪੇਂਟਿੰਗ ਵੱਲੋਂ ਅਗਰ ਤੁਸੀਂ ਦੇਖਿਆ ਜਾਏ ਤਾਂ ਉਹਦੇ ਵਿੱਚ ਮੈਂ ਰਾਧਾ ਕ੍ਰਿਸ਼ਨ ਦੀ ਪੇਂਟਿੰਗ ਬਣਾਈ ਹੋਈ ਸੀਗੀ ਹੋਰ ਵੀ ਕਾਫੀ ਜ਼ਿਆਦਾ ਮੈਂ ਪੇਂਟਿੰਗ ਬਣਾਈਆਂ ਹੋਈਆਂ ਸੀ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਬਣੀਆਂ ਸੀਗੀਆਂ ਅਤੇ ਇਹਨਾਂ ਸਾਰ ਇਹਨਾਂ ਹੁਨਰ ਹੋਣ ਦੇ ਕਰਕੇ ਮੈਨੂੰ ਸਕੂਲ ਵਿੱਚ ਕਈ ਇਨਾਮ ਵੀ ਮਿਲੇ ਸੀਗੇ ਅਤੇ ਮੈਂ ਕਈ ਜ਼ਿਆਦਾ ਜਗ੍ਹਾ 'ਤੇ ਪਾਰਟੀਸਪੇਟ ਵੀ ਕੀਤਾ ਸੀ ਡਰਾਇੰਗ ਦੇ ਵਿੱਚ ਜਿਹਨਾਂ ਵਿੱਚੋਂ ਮੈਨੂੰ ਕਾਫੀ ਜ਼ਿਆਦਾ ਸਰਟੀਫਿਕੇਟਸ ਅਤੇ ਇਨਾਮ ਵੀ ਮਿਲੇ ਸੀਗੇ ਅਤੇ ਜਿਹੜੇ ਮੇਰੇ ਦੋਸਤ ਨੇ ਉਹਨਾਂ ਦਾ ਕਹਿਣਾ ਕਿ ਅਗਰ ਤੂੰ ਹੋਰ ਜ਼ਿਆਦਾ ਮਿਹਨਤ ਕਰੇਂਗੀ ਤਾਂ ਹੋਰ ਜ਼ਿਆਦਾ ਵਧੀਆ ਪੇਂਟਿੰਗ ਬਣਾ ਸਕਦੀ ਹੈ ਅਤੇ ਮੇਰਾ ਇਹ ਮੰਨਣਾ ਕਿ ਮੈਂ ਹੋਰ ਜ਼ਿਆਦਾ ਮਿਹਨਤ ਕਰਕੇ ਹੋਰ ਜ਼ਿਆਦਾ ਵਧੀਆ ਪੇਂਟਿੰਗ ਅਤੇ ਚਿੱਤਰਕਾਰੀ ਕਰਾਂ ਤਾਂ ਕਿ ਮੈਂ ਹੋਰ ਅੱਗੇ ਤੱਕ ਜਾ ਕੇ ਆਪਣੀ ਇਸ ਕਲਾ ਨੂੰ ਇੱਕ ਵਧੀਆ ਮੰਜ਼ਿਲ 'ਤੇ ਲੈ ਕੇ ਜਾ ਸਕਾਂ